ਜਿਵੇਂ ਕਿ ਮੈਂ ਕੱਪੜੇ ਸਿਉਣੇ ਦਾ ਕੰਮ ਕਰਦੀ ਹਾਂ ਅਤੇ ਕੰਮ ਕਰਦੇ ਸਮੇਂ ਰਾਤ ਨੂੰ ਇੱਕ ਦਿਨ ਮੇਰੇ ਤੋਂ ਹੈ ਨਾ ਕਸਟਮਰ ਦੇ ਸੂਟ ਦਾ ਗਲਾ ਬਣਾਉਂਦੇ ਬਣਾਉਂਦੇ ਹੈ ਨਾ ਕੱਟ ਲੱਗ ਗਿਆ ਅਤੇ ਮੈਨੂੰ ਇੰਨੀ ਜ਼ਿਆਦਾ ਟੈਂਸ਼ਨ ਹੋਈ ਵੀ ਮੈਂ ਕਸਟਮਰ ਦਾ ਗਲਾ ਕਿੱਦਾਂ ਠੀਕ ਕਰਾਂ ਇਹਦੇ ਚੱਕਰ ਵਿੱਚ ਮੈਨੂੰ ਨੀਂਦ ਵੀ ਨਹੀਂ ਆਈ ਅਤੇ ਸੁਬਹ ਉੱਠ ਕੇ ਹੈ ਨਾ ਮੈਂ ਉਹਨੂੰ ਗਲੇ ਨੂੰ ਪਹਿਲੇ ਸ਼ੁਰੂ ਤੋਂ ਬਣਾਇਆ ਹੈ ਨਾ ਸਾਰਾ ਜਿੱਦਾਂ ਬਣਾਉਣਾ ਸੀਗਾ ਉਸ ਤੋਂ ਬਾਅਦ ਹੈ ਨਾ ਮੈਂ ਉਹਨੂੰ ਟਾਂ ਅ ਸੂਈ ਦੇ ਨਾਲ ਹਲਕੇ ਹਲਕੇ ਟਾਂਕੇ ਭਰ ਕੇ ਹੈ ਨਾ ਉਹਨੂੰ ਦੁਬਾਰਾ ਐਨ ਸਹੀ ਕਰਤਾ ਅਤੇ ਕੁਛ ਉਹ ਸੂਟ ਪ੍ਰਿਟਿੰਗ ਵਾਲਾ ਸੀਗਾ ਤਾਂ ਕਰਕੇ ਇੰਨਾ ਦਿਖ ਨਹੀਂ ਰਿਹਾ ਤੀਗਾ ਅਤੇ ਹਲਕੇ ਹਲਕੇ ਸੂਈ ਦੇ ਟਾਂਕੇ ਭਰਨ ਨਾਲ ਜਿੱਥੋਂ ਉਹ ਪਟਿਆ ਸੀਗਾ ਉਹ ਬਿਲਕੁਲ ਠੀਕ ਹੋ ਗਿਆ ਇਸ ਤਰ੍ਹਾਂ ਮੈਂ ਜਿਹੜਾ ਮੇਰੇ ਤੋਂ ਸੂਟ ਗਲਤ ਕੱਟਿਆ ਗਿਆ ਸੀ ਬਣਾਉਂਦੇ ਬਣਾਉਂਦੇ ਗਲਾ ਉਹ ਕੱਟ ਲੱਗ ਗਿਆ ਸੀਗਾ ਤਾਂ ਉਹ ਠੀਕ ਹੋ ਗਿਆ ਸੀਗਾ ਫਿਰ ਇਸ ਤੋਂ ਬਾਅਦ